ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਹਰਿੰਦਰ ਜੀ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਮੈਂ ਅਭਿਸ਼ੇਕ ਗੱਲ ਕਰ ਰਿਹਾ ਤੁਸੀਂ ਮੈਂ ਨਾ ਹਜੇ ਨਹਿਰੂ ਮੈਮੋਰੀਅਲ ਕਾਲਜ 'ਚ ਐਡਮਿਸ਼ਨ ਲਿੱਤਾ ਨਵਾਂ ਐਡਮਿਸ਼ਨ ਹੈਗਾ ਮੈਂ ਹਾਂਜੀ ਹਾਂਜੀ ਹਾਂਜੀ ਵਧੀਆ ਜੀ ਵਧੀਆ ਤੁਸੀਂ ਦੱਸੋ ਹਾਂਜੀ ਹਾਂਜੀ ਮੈਂ ਆਉਣਾ ਫਿਰ ਮੈਂ ਇਸ ਕਰਕੇ ਮੈਂ ਕਿਹਾ ਯਾਰ ਪੁੱਛ ਲਈਏ ਇੱਕ ਵਾਰ ਬਈ ਮੌਸਮ ਦਾ ਕੀ ਹਾਲ ਚਾਲ ਹੈਗਾ

ਅੱਛਾ ਅੱਛਾ ਹੂੰ ਹੂੰ ਹਾਂਜੀ ਭਾਅ ਜੀ ਹੋਰ ਕੁਝ ਲੈ ਕੇ ਤਾਂ ਨਹੀਂ ਆਉਣਾ ਮੈਂ ਕਿਹਾ ਵੀ ਮੌਸਮ ਦੇ ਬਾਰੇ ਪੁੱਛ ਲਈਏ ਹਾਲ ਚਾਲ ਬਈ ਕੱਪੜੇ ਕਿਹਦੇ ਹਿਸਾਬ ਨਾਲ ਲੈ ਕੇ ਆਉਣੇ ਮੈਂ ਅੱਛ ਅੱਛਾ ਮੀਂਹ ਮੂਹ ਦਾ ਕੀ ਹਿਸਾਬ ਹੈ ਮੀਂਹ ਮੂਹ ਪੈਂਦਾ ਇੱਥੇ

ਫਿਰ ਤਾਂ ਫਸਲਾਂ ਦਾ ਵੀ ਬੁਰਾ ਹਾਲ ਹੋਣਾ ਫਿਰ ਝੋਨਾ ਲਾਂਦੇ ਇੱਥੇ ਵੀ ਚੰਗਾ ਜੀ ਫਿਰ ਮੈਂ ਤੁਹਾਨੂੰ ਮਿਲ ਰਿਹਾ ਜੀ ਭਾਅ ਜੀ ਫਿਰ ਗੱਲ ਕਰੂੰਗਾ ਤੁਹਾਡੇ ਨਾਲ ਓਕੇ ਜੀ ਓਕੇ ਜੀ ਓਕੇ